ਮੈਂ ਭੌਤਿਕ ਕਿਤਾਬਾਂ ਪੜ੍ਹਨੀਆਂ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਇਹਨਾਂ ਨੂੰ ਕਿਤੇ ਵੀ ਪੜ੍ਹਿਆ ਜਾ ਸਕਦਾ ਹੈ ਭਾਵੇਂ ਪਾਰਕ ਵਿੱਚ ਬਹਿ ਕੇ ਪੜੋ ਭਾਵੇਂ ਲਾਇਬ੍ਰੇਰੀ ਦੇ ਵਿੱਚ ਕਿਤੇ ਵੀ ਪੜ੍ਹਿਆ ਜਾ ਸਕਦਾ ਹੈ ਅਤੇ ਇਹਨਾਂ ਨੂੰ ਕਿਤੇ ਵੀ ਜਿਵੇਂ ਕਿ ਪੋਕਿਟ ਵਿੱਚ ਰੱਖਿਆ ਜਾ ਸਕਦਾ ਜਾਂ ਪਰਸ ਦੇ ਵਿੱਚ ਜਾਂ ਕਿਸੇ ਬੈਗ ਵਿੱਚ ਰੱਖਿਆ ਜਾ ਸਕਦਾ ਹੈ ਪਰ ਜੇ ਅਸੀਂ ਇਲੈਕਟ੍ਰੋਨਿਕ ਗੈਜਟ ਦੀ ਵਰਤੋਂ ਕਰਦੇ ਹਾਂ ਤਾਂ ਉਹਦੇ ਨਾਲ ਸਭ ਤੋਂ ਪਹਿਲਾਂ ਤਾਂ ਅੱਖਾਂ ਖਰਾਬ ਹੋਣ ਦੀ ਸੰਭਾਵਨਾ ਹੈ ਅਤੇ ਗੈਜਟ ਹਰ ਵੇਲੇ ਓਪਨ ਰੱਖਣਾ ਪੈਂਦਾ ਹੈ ਅਤੇ ਫੋਨ ਵੀ ਹਰ ਵੇਲੇ ਚਾਲੂ ਰੱਖਣਾ ਪੈਂਦਾ ਹੈ ਮੈਂ ਆਡੀਓ ਬੁੱਕ ਇੱਕ ਦੋ ਸੁਣੀਆਂ ਹਨ ਪਰ ਮੈਨੂੰ ਜ਼ਿਆਦਾਤਰ ਭੌਤਿਕ ਕਿਤਾਬਾਂ ਪੜ੍ਹਨਾ ਹੀ ਵਧੀਆ ਲੱਗਦਾ ਹੈ ਕਿਉਂਕਿ ਇਲੈਕਟ੍ਰੋਨਿਕ ਦੀ ਵਰਤੋਂ ਕਰਨ ਦੇ ਨਾਲ ਸਿਹਤ ਦਾ ਨੁਕਸਾਨ ਹੈ ਅਤੇ ਫੋਨ ਵੀ ਚਾਲੂ ਰੱਖਣਾ ਪੈਂਦਾ ਹੈ ਆਡੀਓ ਬੁੱਕ ਸੁਣਨ ਦੇ ਨਾਲ ਬਹੁਤ ਸਾਰੇ ਨੁਕਸਾਨ ਇਹ ਹਨ